ਸਾਡੀ ਮਾਤ ਭਾਸ਼ਾ ਪੰਜਾਬੀ ਹੈ ਅਸੀਂ ਸਕੂਲ ਲੱਗਣ ਤੋਂ ਪਹਿਲਾਂ ਹੀ ਪੰਜਾਬੀ ਸਿੱਖੀ ਸੀ ਹੁਣ ਸਾਨੂੰ ਸਕੂਲਾਂ ਵਿੱਚ ਵੀ ਪੰਜਾਬੀ ਸਿਖਾਈ ਜਾਂਦੀ ਹੈ ਹੁਣ ਅਸੀਂ ਲ ਗ੍ਰੈਜੂਏਸ਼ਨ ਕਰ ਰਹੇ ਹਾਂ ਉਸ 'ਚ ਵੀ ਸਾਨੂੰ ਪੰਜਾਬੀ ਰੱਖੀ ਹੈ ਸਾਨੂੰ ਪੰਜਾਬੀ ਪੜ੍ਹਨਾ ਬਹੁਤ ਪਸੰਦ ਹੈ ਅਤੇ ਅਸੀਂ ਹੁਣ ਇਲੈਕਟਿਵ ਪੰਜਾਬੀ ਵੀ ਰੱਖੀ ਹੈ ਇਲੈਕਟਿਵ ਸਾਨੂੰ ਸਾਨੂੰ ਪੰਜਾਬੀ ਸਾਹਿਤ ਵੀ ਰਖਵਾਈ ਹੈ ਮੈਨੂੰ ਪੰਜਾਬੀ ਬੋਲਣਾ ਬਹੁਤ ਪਸੰਦ ਹੈ ਸਾਡੇ ਗੁਰੂਆਂ ਨੇ ਵੀ ਦਸਾਂ ਗੁਰੂਆਂ ਨੇ ਜਿਹੜਾ ਸਾਹਿਤ ਲਿਖਿਆ ਉਹ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਇਸ ਇਸ ਲਈ ਸਾਨੂੰ ਪੰਜਾਬੀ ਬਹੁਤ ਵਧੀਆ ਲੱਗਦੀ ਹੈ ਪੰਜਾਬੀ ਪਾ ਤੋਂ ਵਧੀਆ ਕੋਈ ਹੋਰ ਲੈਂਗੁਏਜ ਹੈ ਨਹੀਂ ਪੰਜਾਬੀ ਵਿੱਚ ਹੀ ਅਸੀਂ ਸਾਰਾ ਕੰਮ ਕਰਦੇ ਹਾਂ ਪੰਜਾਬੀ ਇਸ ਕਰਕੇ ਸਾਡੇ ਸਾਹਿਤ ਲਈ ਬਹੁਤ ਹੀ ਵਧੀਆ ਹੈ ਸਾਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ ਸਾਨੂੰ ਘਰਾਂ ਵਿੱਚ ਵੀ ਪੰਜਾਬੀ ਸਿਖਾਈ ਜਾਂਦੀ ਹੈ ਅਤੇ ਅਸੀਂ ਵੱਡੇ ਹੋ ਕੇ ਵੀ ਪੰਜਾਬੀ ਹੀ ਬੋਲਦੇ ਹਾਂ ਧੰਨਵਾਦ